ਹਾਂ ਵਧੀਆ ਵਧੀਆ ਤੂੰ ਸੁਣਾ ਕਿਵੇਂ ਹੈ ਹਾਂ ਠੀਕ ਹੈ ਤੁਸੀਂ ਸੁਣਾਓ ਠੀਕ ਹੈ ਕਿਵੇਂ ਹੋਰ ਕੀ ਹਾਲ ਚਾਲ ਆ ਹਾਂ ਫ੍ਰੀ ਸੀ ਟਾਈਮ ਹੀ ਆਪਣੇ ਕੋਲ ਹਾਂ ਬਿਲਕੁਲ ਦੱਸੋ ਅੱਛਾ ਠੀਕ ਹਾਂ ਉਹ ਪਤਾ ਕੀ ਹੈ ਕਈ ਵਰੀ ਉਦਾਸੀ ਦੇ ਦਿਨ ਆ ਜਾਂਦੇ ਨਾ ਫਿਰ ਓਦਾਂ ਇੱਦਾਂ ਹੋ ਜਾਂਦਾ ਹੈ ਮੈਂ ਨਾ ਤੁਸੀਂ ਆਪਣੇ ਆਪ ਨੂੰ ਬੀਜੀ ਰੱਖਿਆ ਕਰ ਵੱਧ ਤੋਂ ਵੱਧ ਬੀਜੀ ਰੱਖ ਆਪਣੇ ਆਪ ਨੂੰ ਜਾਂ ਕੋਈ ਕਿਤਾਬ ਪੜ੍ਹ ਜਾਂ ਕੋਈ ਕਿਸੇ ਤਰ੍ਹਾਂ ਮੇਰੇ ਕੋਲ ਹੈਗੀ ਹੈ ਕਿਤਾਬ ਇੱਕ ਉਹਦਾ ਨਾਮ ਹੈਗਾ ਪੋਥੀ ਪਰਮੇਸ਼ਰ ਕਾ ਥਾਨ ਅਤੇ ਉਹ ਆਪਣੇ ਮਹਾਂਪੁਰਖਾਂ ਦੀ ਲਿਖੀ ਹੋਈ ਹੈ ਮਹਾਂਪੁਰਖ ਹੈਗੇ ਹੈ ਓਧਰ ਪ੍ਰਭ ਮਿਲਨੇ ਕਾ ਚਾਓ ਦੇ ਮਹਾਂਪੁਰਖਾਂ ਸੇਵਾ ਸਿੰਘ ਸਰਮਾਲਾ ਉਨ੍ਹਾਂ ਦੀ ਲਿਖੀ ਹੋਈ ਹੈ ਉਹਦੇ 'ਚੋਂ ਸਾਨੂੰ ਬਹੁਤ ਗਿਆਨ ਮਿਲੂਗਾ ਉਹਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗਿਆਨ ਹੈ ਨਾ ਜੇ ਸਾਨੂੰ ਸਮਝ ਨਹੀਂ ਲੱਗਦੀ ਉਹ ਸਾਨੂੰ ਉਹ ਦੱਸਦੇ ਹੈ ਵੀ ਉਹ ਗਿਆਨ ਨੂੰ ਉਹ ਗਿਆਨ ਦਾ ਪ੍ਰਕਾਸ਼ ਉਹ ਗਿਆਨ ਨੂੰ ਅਸੀਂ ਸੋਚ ਕਿਵੇਂ ਮਤ ਲੈ ਕੇ ਅੱਗੇ ਚੱਲਣਾ ਅਸੀਂ ਆਪਣਾ ਜੀਵਨ ਕਿਵੇਂ ਬਦਲ ਸਕਦਾ ਉਹਦੇ ਵਿੱਚ ਇੰਨਾ ਵਧੀਆ ਗਿਆਨ ਦਿੱਤਾ ਵਿਆ ਨਾ ਸਾਡਾ ਸਾਨੂੰ ਇੱਦਾਂ ਨਹੀਂ ਗਾ ਵੀ ਨਾ ਤਾਂ ਕੋਈ ਫਾਲਤੂ ਵਿਚਾਰ ਆਵੇ ਨਾ ਸਾਨੂੰ ਉਦਾਸੀ ਲੱਗੇ ਅਤੇ ਉਹਦੇ ਵਿੱਚ ਇੰਨਾ ਵਧੀਆ ਗਿਆਨ ਦਿੱਤਾ ਵਾ ਉਹ ਗਿਆਨ ਲੈ ਕੇ ਅਸੀਂ ਆਪਣੀ ਜ਼ਿੰਦਗੀ ਦੇ ਰਸਤੇ ਦੇ ਵਿੱਚ ਬਹੁਤ ਅਸਾਨ ਤਰੀਕੇ ਦੇ ਨਾਲ ਅੱਗੇ ਜਾ ਸਕਦੇ ਹਾਂ ਉਹਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ ਵੀ ਅਸੀਂ ਆਪਣਾ ਅਸੀਂ ਆਪਣੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਜਿਹੜੇ ਸਾਨੂੰ ਅਸੀਂ ਆਪਣੇ ਵਿਚਾਰ ਮਾਰਨੇ ਆ ਅਤੇ ਵਿਚਾਰ ਕਿਵੇਂ ਮਾਰਨੇ ਹੈ ਅਤੇ ਜਦੋਂ ਸਾਡੇ ਵਿਚਾਰ ਮਰ ਗਏ ਨਾ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਡਿਪ੍ਰੈਸ਼ਨ ਨਹੀਂ ਸਾਡੇ ਤੱਕ ਆਪ ਆਪੋ ਆਪਣੇ ਸਾਨੂੰ ਆਪਣੇ ਕੰਮ ਦੀ ਸੋਝੀ ਆਈ ਜਾਂਦੀ ਹੈ ਅਤੇ ਸਾਡੇ ਸਾਰੇ ਕੰਮ ਅਸਾਨ ਹੋ ਜਾਂਦੇ ਹੈ ਨਾ ਸਾਨੂੰ ਕੋਈ ਚਿੰਤਾ ਨਾ ਸਾਨੂੰ ਕੋਈ ਟੈਨਸ਼ਨ ਰਹਿੰਦੀ ਹੈ ਸਾਨੂੰ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਹੈ ਵੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਕਹਿੰਦੇ ਚਿੰਤਨ ਕਰੋ ਚਿੰਤਾ ਨਾ ਕਰੋ ਪਰ ਹੁਣ ਇਹ ਸਾਨੂੰ ਮੱਲੋ ਮੱਲੀ ਆ ਜਾਂਦੀ ਹੈ ਅਤੇ ਹੁਣ ਇਹਨੂੰ ਹਟਾਉਣ ਵਾਸਤੇ ਉਹ ਸਾਨੂੰ ਮਹਾਂਪੁਰਖ ਗਿਆਨ ਦੱਸਦੇ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗਿਆਨ ਉਹਨੂੰ ਵਿਸਥਾਰ ਨਾਲ ਖੋਲ੍ਹ ਕੇ ਸੰਖੇਪ ਵਿੱਚ ਦੱਸਦੇ ਹੈ ਵੀ ਅਸੀਂ ਉਹਦੇ 'ਤੇ ਚੱਲਣਾ ਕਿਵੇਂ ਹੈ ਤਾਂ ਕਿ ਸਾਡਾ ਜੀਵਨ ਬਦਲ ਜਾਵੇ ਨਾ ਸਾਨੂੰ ਕੋਈ ਟੈਨਸ਼ਨ ਹੋਵੇ ਨਾ ਸਾਨੂੰ ਕੋਈ ਮਨ ਵਿੱਚ ਉਦਾਸੀ ਆਵੇ ਜਦੋਂ ਅਸੀਂ ਆਪਣਾ ਗੱਲ ਸਾਰੀ ਧਿਆਨ ਦੀ ਦੱਸਦੇ ਹੈ ਵੀ ਅਸੀਂ ਆਪਣਾ ਧਿਆਨ ਇੱਧਰੋਂ ਪੱਟ ਕੇ ਉੱਧਰੋਂ ਲਾ ਲਾਂਗੇ ਨਾ ਜਿਵੇਂ ਕਹਿੰਦੇ ਨਾ ਬੁੱਲ੍ਹੇ ਸ਼ਾਹ ਕਹਿੰਦਾ ਵੀ ਬੁੱਲ੍ਹਿਆ ਕਹਿੰਦੇ ਇਹਦਾ ਕੀ ਲਾਉਣਾ ਕਹਿੰਦੇ ਇੱਧਰੋਂ ਪੱਟਣਾ ਤੇ ਪਨੀਰੀ ਦਾ ਕੀ ਲਾਉਣਾ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ ਇੱਦਾਂ ਇਹ ਧਿਆਨ ਦੀ ਗੱਲ ਹੈ ਸਾਰੀ ਧਿਆਨ ਜਦੋਂ ਅਸੀਂ ਧਿਆਨ ਆਪਣਾ ਵਿਚਾਰਾਂ 'ਚ ਲੈ ਜਾਂਦੇ ਹੈ ਨਾ ਓਦੋਂ ਸਾਡਾ ਮਨ ਜ਼ਿਆਦਾ ਡੀਮੋਟੀਵੇਟ ਹੋ ਜਾਂਦਾ ਅਤੇ ਇਸ ਵਾਸਤੇ ਸਾਨੂੰ ਇਹਦੇ ਵਾਸਤੇ ਕਿਸੇ ਮਹਾਂਪੁਰਖਾਂ ਸੰਤਾਂ ਮਹਾਂਪੁਰਖਾਂ ਦੀ ਲੋੜ ਹੁੰਦੀ ਹੈ ਵੀ ਸਾਨੂੰ ਜੀਵਨ ਦੇ ਵਿੱਚ ਸਾਡਾ ਮਾਰਗ ਦਰਸ਼ਨ ਕਰਨ ਸਾਨੂੰ ਉਸ 'ਤੇ ਚੱਲਣ ਦਾ ਰਸਤਾ ਦੱਸਣ ਅਤੇ ਆਪਣੇ ਕੋਲ ਬਹੁਤ ਸਾਰੀਆਂ ਕਿਤਾਬਾਂ ਪਈਆਂ ਮਹਾਂਪੁਰਖਾਂ ਦੀਆਂ ਇੱਕ ਹੈਗੀ ਹੈ ਉਨ੍ਹਾਂ 'ਚੋਂ ਸਾਰਿਆਂ ਨਾਲੋਂ ਵਧੀਆ ਪੋਥੀ ਪਰਮੇਸ਼ਰ ਕਾ ਥਾਨ ਉਹਦੇ ਵਿੱਚ ਉਨ੍ਹਾਂ ਨੇ ਬਹੁਤ ਵਧੀਆ ਗਿਆਨ ਦਿੱਤਾ ਉਹ ਗਿਆਨ ਨੂੰ ਲੈ ਕੇ ਉਹ ਤੋਂ ਪੜ੍ਹ ਕੇ ਉਹਦੇ ਤੋਂ ਤੂੰ ਆਪਣਾ ਜੀਵਨ ਬਦਲ ਸਕਦੀ ਹੈ ਹਾਂ ਜ਼ਰੂਰ ਜ਼ਰੂਰ ਜ਼ਰੂਰ ਹਾਂ ਉਹ ਉਹ ਦੀਵਾਨ ਲਾਉਂਦੇ ਹੈ ਉਨ੍ਹਾਂ ਦੇ ਆਏ ਸ਼ਨੀਵਾਰ ਅਤੇ ਐਤਵਾਰ ਸਮਾਗਮ ਹੁੰਦੇ ਹੈ ਫਿਰ ਮਾਰਚ ਦੇ ਮਹੀਨੇ ਦਸਾਂ ਦਿਨਾਂ ਦਾ ਕੈਂਪ ਲੱਗਦਾ ਉਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਸਾਰੇ ਪੇਰੈਂਟਸ ਸਮੇਤ ਪਰਿਵਾਰ ਉੱਥੇ ਦਸ ਦਿਨ ਰਹਿੰਦੇ ਹੈ ਉੱਧਰੋਂ ਦਸੰਬਰ ਮਹੀਨੇ ਦੇ ਵਿੱਚ ਉਹ ਦਸਾਂ ਦਿਨਾਂ ਦੇ ਕੈਂਪ ਲਾਉਂਦੇ ਹੈ ਅਤੇ ਉੱਥੇ ਉਹ ਬਹੁਤ ਜ਼ਿਆਦਾ ਨੇੜਿਓ ਉਨ੍ਹਾਂ ਨੂੰ ਅਸੀਂ ਸੁਣ ਸਕਦੇ ਹਾਂ ਅਤੇ ਉਨ੍ਹਾਂ ਤੋਂ ਗਿਆਨ ਲੈ ਕੇ ਅਸੀਂ ਆਪਣਾ ਜੀਵਨ ਬਦਲ ਸਕਦੇ ਹਾਂ ਠੀਕ ਹੈ ਹਾਂ ਓਕੇ ਬਾਏ